ਵਿਗਿਆਨ ਅਤੇ ਟੈਕਨੋਲੋਜੀ ਨੇ ਮਹਾਂਮਾਰੀ ਜਿਵੇਂ ਕਰੋਨਾ ਦਾ ਆਇਆ ਸੀ ਉਦੋਂ ਬਹੁਤ ਲੋਕਾਂ ਦੀ ਹੈਲਪ ਹੋਈ ਆ ਬਹੁਤ ਅਧਿਐਨ ਵੀ ਹੋਇਆ ਕਿਉਂਕਿ ਸੋਸ਼ਲ ਮੀਡੀਆ 'ਤੇ ਇਹ ਨਵੀਆਂ ਨਵੀਆਂ ਟਕਨੀਕਾਂ ਦੁਆਰਾ ਅਸੀਂ ਇਸ ਮਹਾਂਮਾਰੀ ਤੋਂ ਛੁਟਕਾਰਾ ਪਾ ਸਕੇ ਹਾਂ ਇਹ ਅਧਿਐਨ ਜਿਵੇਂ ਵੀ ਨਵੀਂ ਨਵੀਂ ਟੈਕਨੀਕਸ ਦੇ ਨਾਲ ਹੋਇਆ ਤਾਂ ਹੈਲਪ ਮਿਲੀ ਬਹੁਤ ਸਾਰਾ ਨੁਕਸਾਨ ਹੋਣ ਤੋਂ ਬਚੇ ਹੈ ਇਹ ਬਹੁਤ ਜ਼ਿਆਦਾ ਮਤਲਬ ਵਿਗਿਆਨਿਕ ਤੇ ਅਤੇ ਟੈਕਨੋਲੋਜੀ ਨਾਲ ਬੈਨੀਫਿਟ ਹੈ ਅੱਜ ਕੱਲ੍ਹ ਦਾ ਅੱਜ ਕੱਲ੍ਹ ਦੇ ਇਸ ਮੋ ਉਸ 'ਚ ਬਟ ਜੇ ਇਹਦੀ ਕਹੀਏ ਵੀ ਡਿਜੀਟਲ ਸਿਖਲਾਈ ਮੈਨੂੰ ਇਹਦੇ ਬਾਰੇ ਕੁਛ ਖਾਸ ਨਹੀਂ ਪਤਾ ਅਤੇ ਇਹਦੇ ਫਾਇਦੇ ਇਹ ਹੈ ਕਿ ਜੇ ਤੁਸੀਂ ਮਤਲਬ ਅੱਜ ਕੱਲ੍ਹ ਦਾ ਨਵੀਂ ਡਿਜੀਟਲ ਜੋ ਵੀ ਚੱਲ ਰਿਹਾ ਇਹ ਇਹਦੇ ਨਾਲ ਤੁਸੀਂ ਘਰ ਬੈਠੇ ਬਹੁਤ ਕੁਛ ਪਤਾ ਕਰ ਸਕਦੇ ਹੋ ਦੂਰ ਜਾਣ ਦੀ ਲੋੜ ਨਹੀਂ ਘਰ ਬੈਠੇ ਹੀ ਸਾਰੀ ਕੁਛ ਨਵੀਂ ਟੈਕਨੀਕਸ ਬਾਰੇ ਪਤਾ ਲੱਗ ਜਾਂਦਾ ਤੁਹਾਨੂੰ